ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਦੱਸੋ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਓਕੇ ਜੀ ਹਾਂਜੀ ਓਕੇ ਜੀ ਓਕੇ ਹਾਂਜੀ ਜ਼ਰੂਰ ਸਾਡੇ ਜਿਹੜੀ ਸੁਸਾਇਟੀ ਆ ਭਾਈ ਸੇਵਾ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਇਸ ਦੇ ਅੰਦਰ ਅਸੀਂ ਲੋੜਵੰਦ ਬੱਚਿਆਂ ਅਤੇ ਬਜ਼ੁਰਗਾਂ ਨੂੰ ਜਿਹਨਾਂ ਨੂੰ ਘਰੋਂ ਉਹ ਨਹੀਂ ਆਪਣੇ ਐਫਰਟ ਕਰ ਸਕਦੇ ਹੈਗੇ ਅਤੇ ਉਹਨਾਂ ਨੂੰ ਜ਼ਰੂਰਤ ਹੈ ਜਾਂ ਉਹ ਗਰੀਬ ਰੇਖ ਗਰੀਬੀ ਰੇਖਾ ਤੋਂ ਨੀਚੇ ਨੇ ਅਸੀਂ ਉਹਨਾਂ ਦੀ ਸਿੱਖਿਆ ਲਈ ਅਤੇ ਉਹਨਾਂ ਦੇ ਵਿਕਾਸ ਲਈ ਇਹ ਸਾਰੇ ਪ੍ਰਬੰਧ ਔਰਗਨਾਈਜ਼ ਕਰਦੇ ਹਾਂ ਅਸੀਂ ਉਹਨਾਂ ਨੂੰ ਮੁਫਤ ਸਿੱਖਿਆ ਦਿੰਦੇ ਹਾਂ ਸਾਡੀ ਸ ਸੋਸਾਇਟੀ ਵੱਲੋਂ ਪਹਿਲੀ ਤੋਂ ਅੱਠਵੀਂ ਤੱਕ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਸਾਡੀ ਸੋਸਾਇਟੀ ਵੱਲੋਂ ਫਰੀ ਵਿੱਚ ਉਹਨਾਂ ਨੂੰ ਦਿੱਤੀ ਜਾਂਦੀ ਹੈ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਹਨਾਂ ਦੇ ਰੋਜ਼ਾਨਾ ਭੋਜਨ ਦਾ ਖਾਣ ਪੀਣ ਦਾ ਅਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਕੀਤਾ ਜਾਂਦਾ ਬਜ਼ੁਰਗਾਂ ਲਈ ਵੀ ਓਲਡ ਏਜ ਹੋਮ ਦੀ ਸੁਵਿਧਾ ਹੈਗੀ ਆ ਜਿਹਦੇ ਵਿੱਚ ਉਹ ਆਪ ਰਹਿ ਸਕਦੇ ਨੇ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਅਤੇ ਸਾਡੇ ਨਾਲ ਅਸੀਂ ਉਹਨਾਂ ਦੀ ਆਪ ਦੇਖਭਾਲ ਕਰਦੇ ਹਾਂ ਸਾਡੇ ਸਕੂਲ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਅਸੀਂ ਫਸਟ ਤੋਂ ਏਟਥ ਤੱਕ ਦੀ ਸਿੱਖਿਆ ਪ੍ਰੋਵਾਈਡ ਕਰਵਾਉਂਦੇ ਹਾਂ ਬੱਚਿਆਂ ਨੂੰ ਇਸ ਦੇ ਨਾਲ ਅਸੀਂ ਅਲੱਗ ਅਲੱਗ ਪਿੰਡਾਂ ਜਾਂ ਸ਼ਹਿਰਾਂ ਵਿੱਚ ਜਾ ਕੇ ਕੈਂਪ ਔਰਗਨਾਈਜ਼ ਕਰਦੇ ਹਾਂ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਜਾਗਰੂਕ ਕਰਵਾਉਂਦੇ ਹਾਂ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਅਤੇ ਜਿਹੜੇ ਲੋੜਵੰਦ ਨੇ ਅਸੀਂ ਉਹਨਾਂ ਦੀ ਆਪ ਸਹਾਇਤਾ ਵੀ ਕਰਦੇ ਹਾਂ ਹਾਂਜੀ ਅਸੀਂ ਸਮੇਂ ਸਮੇਂ 'ਤੇ ਕੈਂਪ ਲਗਵਾਉਂਦੇ ਰਹਿੰਦੇ ਆਪਣੇ ਐੱਨ ਜੀ ਓ ਦੇ ਜਿਹਦੇ ਵਿੱਚ ਡਾਕਟਰੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਗਰੀਬ ਪਿੰ ਪਿੰਡਾਂ ਦੇ ਵਿੱਚ ਜਾ ਕੇ ਗਰੀਬ ਲੋਕਾਂ ਦੀ ਸਿਹਤ ਬਾਰੇ ਜਾਂਚ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਓਕੇ ਜੀ ਓਕੇ ਤੁਸੀਂ ਮੈਨੂੰ ਆਪਣੇ ਪਿੰਡ ਦਾ ਨਾਮ ਦੱਸ ਦਿਓ ਪਲੀਜ਼ ਅਤੇ ਅਸੀਂ ਅਗਲੇ ਹਫਤੇ ਤੁਹਾਡੇ ਪਿੰਡ ਦੇ ਵਿੱਚ ਹੀ ਇਹ ਕੈਂਪ ਔਰਗਨਾਈਜ਼ ਕਰਾਂਗੇ ਓਕੇ ਜੀ ਹਾਂਜੀ ਜ਼ਰੂਰ ਤੁਸੀਂ ਆਪਣਾ ਯੋਗਦਾਨ ਸਾਡੀ ਸੰਸਥਾ ਵਿੱਚ ਪਾ ਸਕਦੇ ਹੋ ਇਹ ਬਹੁਤ ਪੁੰਨ ਵਾਲਾ ਬਹੁਤ ਵੱਡਾ ਕੰਮ ਹੈ ਅਤੇ ਮੈਂ ਤੁਹਾਨੂੰ ਇਹ ਕੰਮ ਕਰਨ ਲਈ ਤੁਹਾਡਾ ਧੰਨਵਾਦ ਵੀ ਕਰਦੀ ਹਾਂ ਅਤੇ ਤੁਹਾਨੂੰ ਉਤਸ਼ਾਹਿਤ ਵੀ ਕਰਦੀ ਹਾਂ ਕਿ ਤੁਸੀਂ ਹੋਰ ਲੋਕਾਂ ਨੂੰ ਵੀ ਇਹੋ ਜਿਹੇ ਪੁੰਨ ਵਾਲੇ ਕੰਮ ਕਰਨ ਲਈ ਉਤਸ਼ਾਹਿਤ ਕਰੋ ਧੰਨਵਾਦ ਜੀ ਧੰਨਵਾਦ ਤੁਹਾਡਾ ਹਾਂਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ